ਸਤਿ ਸ਼੍ਰੀ ਅਕਾਲ ਜੀ ਮੈਂ ਕੁਛ ਦਿਨਾਂ ਪਹਿਲਾਂ ਤੁਹਾਡੇ ਤੋਂ ਇੱਕ ਹੈਂਡਬੈਗ ਔਡਰ ਕੀਤਾ ਸੀਗਾ ਜਿਸਦੀ ਡਿਲੀਵਰੀ ਮੈਨੂੰ ਔਨ ਦਾ ਟਾਈਮ ਸਹੀ ਟਾਈਮ 'ਤੇ ਮਿਲ ਗਈ ਸੀਗੀ ਅਤੇ ਡਿਲੀਵਰੀ ਡਿਲੀਵਰੀ ਬੋਆਏ ਨੇ ਵੀ ਮੇਰੇ ਤੋਂ ਕੋਈ ਵੀ ਐਕਸਟ੍ਰਾ ਚਾਰਜਰਸ ਨਹੀਂ ਲਏ ਅਤੇ ਉਹਦੀ ਪੈਕਿੰਗ ਵੀ ਬਹੁਤ ਜ਼ਿਆਦਾ ਵਧੀਆ ਸੀਗੀ ਜਿਹੜੇ ਕਲਰ ਦਾ ਮੈਂ ਬੈਗ ਔਡਰ ਕੀਤਾ ਸੀ ਮੈਨੂੰ ਉਹੀ ਕਲਰ ਵਿੱਚ ਬੈਗ ਮਿਲਿਆ ਅਤੇ ਇਹ ਇੰਨਾਂ ਜ਼ਿਆਦਾ ਵਧੀਆ ਏ ਕਿ ਇਹਦੇ ਵਿੱਚ ਇੰਨੀ ਜਿਆਦਾ ਸਪੇਸ ਹੈ ਕਿ ਇਹਦੇ ਵਿੱਚ ਅਸੀਂ ਕੁਛ ਵੀ ਆਪਣਾ ਸਮਾਨ ਰੱਖ ਸਕਦੇ ਹਾਂ ਅਤੇ ਇਹਦੇ ਵਿੱਚ ਜੋ ਚੇਂਨਸ ਲੱਗੀਆਂ ਹੋਈਆਂ ਏ ਉਹ ਵੀ ਬੜੀਆਂ ਫਲੈਕਸੀਬਲ ਹੈ ਅਤੇ ਮਜਬੂਤ ਹੈ ਅਤੇ ਇਹਦੇ ਵਿਚ ਹੋਰ ਸਮਾਨ ਰੱਖਣ ਨੂੰ ਐਕਸਟ੍ਰਾ ਪੋਕਿਟ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਆਪਣੀ ਮਨੀ ਰੱਖ ਸਕਦੇ ਹਾਂ ਅਤੇ ਇਹ ਮਾਰਕਿਟ ਨਾਲੋਂ ਵੀ ਮੈਨੂੰ ਸਸਤੇ ਰੇਟ 'ਤੇ ਮਿਲਿਆ ਏ ਅਤੇ ਇਹਦੇ ਵਿੱਚ ਅਸੀਂ ਇੱਕ ਚੇਨ ਬਣਾ ਕੇ ਇਹਨੂੰ ਸਾਈਡ ਬੈਗ ਦੀ ਤਰ੍ਹਾਂ ਵੀ ਯੂਜ ਕਰ ਸਕਦੇ ਹਾਂ ਜਦੋਂ ਮੇਰੇ ਫਰੈਂਡਸ ਨੇ ਇਹ ਬੈਗ ਦੇਖਿਆ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਮੈਨੂੰ ਐਵੇਂ ਦਾ ਹੀ ਬੈਗ ਮੰਗਵਾ ਕੇ ਦੇ ਅਤੇ ਮੈਂ ਉਹਨਾਂ ਨੂੰ ਵੀ ਔਡਰ ਕਰਵਾਇਆ ਅਤੇ ਸਭ ਨੂੰ ਇਹ ਬੈਗ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਇਹਦੀ ਕੁਆਲਿਟੀ ਅਤੇ ਕੁਆਂਟਿਟੀ ਬਹੁਤ ਜ਼ਿਆਦਾ ਵਧੀਆ ਏ ਜਿਸ ਕਾਰਨ ਸਭ ਨੇ ਇਹਦੀ ਬਹੁਤ ਜ਼ਿਆਦਾ ਪ੍ਰਸੰਸਾ ਕੀਤੀ ਮੈਂ ਤੁਹਾਡੇ ਇਸ ਪ੍ਰੋਡਕਟ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ